ਯੂਟਿਊਬ ਦੇ ਉੱਤੇ ਬਹੁਤ ਸਾਰੀ ਭਾਸ਼ਾਵਾਂ ਦੇ ਵਿੱਚ ਬਹੁਤ ਜ਼ਿਆਦਾ ਲਰਨਿੰਗ ਵਾਲੇ ਚੈਨਲ ਹਨ ਜਿਵੇਂ ਕਿ ਇੰਗਲਿਸ਼ ਦੇ ਵਿੱਚ ਬਹੁਤ ਜ਼ਿਆਦਾ ਵਰਾਇਟੀ ਦੇਖਣ ਨੂੰ ਮਿਲਦੀ ਹੈ ਜੋ ਬੱਚਿਆਂ ਨੂੰ ਲਰਨਿੰਗ ਦੇ ਵਿੱਚ ਮਦਦ ਕਰਦੇ ਹਨ ਅਤੇ ਇਸੇ ਤਰ੍ਹਾਂ ਪੰਜਾਬੀ ਦੇ ਵਿੱਚ ਵੀ ਕੁਝ ਯੂਟਿਊਬ ਚੈਨਲ ਹਨ ਜੋ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਮਦਦ ਕਰਦੇ ਹਨ ਫੋਰ ਇਗਜਾਮਪਲ ਪੰਜਾਬੀ ਕਲਾਸ ਕੈਟਰੈਕਿਡਸ ਇੱਦਾਂ ਦੀ ਯੂਟਿਊਬ ਚੈਨਲ ਐਕਚੁਅਲ ਦੇ ਵਿੱਚ ਪੰਜਾਬੀਆਂ ਦੀ ਪੰਜਾਬੀ ਸਿੱਖਣ ਵਾਲਿਆਂ ਲਈ ਬਹੁਤ ਲਾਭਦਾਇਕ ਹਨ ਅਤੇ ਮੈਂ ਚਾਹੁੰਦੀ ਹਾਂ ਕਿ ਪੰਜਾਬੀ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਵਰਾਇਟੀ ਹੋਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਨੂੰ ਕੋਈ ਟਿਊਸ਼ਨ ਕੁਛ ਰੱਖਣ ਦੀ ਲੋੜ ਨਾ ਪਵੇ ਉਹ ਇਹ ਸਿੰਪਲੀ ਯੂਟਿਊਬ ਵੀਡੀਓਸ ਦੇ ਨਾਲ ਆਪਣੀ ਪੰਜਾਬੀ ਦੀ ਵੋਕੈਬਲਰੀ ਨੂੰ ਇਮਪਰੂਵ ਕਰ ਸਕਣ ਅਤੇ ਹੋਰ ਪੰਜਾਬੀ ਭਾਸ਼ਾ ਦੇ ਵਿੱਚ ਜ਼ਿਆਦਾ ਆਪਣਾ ਧਿਆਨ ਰੁਚੀ ਲਗਾ ਸਕਣ ਅਤੇ ਅੱਜ ਦੇ ਸਮੇਂ ਵਿੱਚ ਜੋ ਜਿੱਥੇ ਪੰਜਾਬੀ ਭਾਸ਼ਾ ਅਲੋਪ ਹੋ ਰਹੀ ਹੈ ਉੱਥੇ ਪੰਜਾਬੀ ਨੂੰ ਉੱਪਰਲੇ ਪੱਧਰ 'ਤੇ ਲੈ ਕੇ ਜਾਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਤੇ ਇਸ ਇਸ ਵਿੱਚ ਪੰਜਾਬੀ ਅਧਿਆਪਕ ਆਪਣਾ ਉਹ ਆਪਣਾ ਰੋਲ ਪੇਸ਼ ਕਰ ਸਕਦੇ ਹਨ